ਪੰਜਾਬ ਵਿੱਚ ਕਲਾ ਅਤੇ ਸ਼ਿਲਪ ਦੇ ਖੇਤਰ ਵਿੱਚ ਆਰਥਿਕ ਵਿਕਾਸ ਬਹੁਤ ਹੋ ਰਿਹਾ ਹੈ ਫੁਲਕਾਰੀ ਪੰਜਾਬ ਦਾ ਇੱਕ ਇਹੋ ਜਿਹੀ ਕਲਾ ਹੈ ਜਿਸਨੂੰ ਜਨਾਨੀਆਂ ਘਰ ਬੈਠੇ ਵੀ ਬਣਾਉਂਦੀਆਂ ਹਨ ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੁਜ਼ਗਾਰ ਵੀ ਮਿਲ ਜਾਂਦਾ ਹੈ ਫੁਲਕਾਰੀ ਇੱਕ ਇਹੋ ਜਿਹੀ ਕਢਾਈਆਂ ਹੁੰਦੀਆਂ ਹਨ ਜਿਸਨੂੰ ਪੰਜਾਬ ਦੀਆਂ ਜਨਾਨੀਆਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਹਨ ਘਰ ਘਰ ਵਿੱਚ ਲੋਕ ਜਨਾਨੀਆਂ ਕਢਾਈਆਂ ਕੱਢਦੀਆਂ ਹਨ ਅਤੇ ਫੁਲਕਾਰੀ ਦੇ ਨਾਲ ਉਹਨਾਂ ਨੂੰ ਇੱਕ ਤਰ੍ਹਾਂ ਦਾ ਰੁਜ਼ਗਾਰ ਵੀ ਮਿਲ ਜਾਂਦਾ ਹੈ ਫੁਲਕਾਰੀ ਕਢਾਈ ਦੇ ਨਾਲ ਉਹ ਚੁੰਨੀਆਂ ਸ਼ੋਲਾਂ ਦੇ ਉੱਤੇ ਇਹੋ ਜਿਹੀਆਂ ਕਢਾਈਆਂ ਕੱਢਦੀਆਂ ਹਨ ਜਿਹੜਾ ਦੂਰ ਦਰੂ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਲੋਕਾਂ ਬਹੁਤ ਸਾਰਾ ਪਸੰਦ ਕਰਦੇ ਹਨ ਇਥੋਂ ਤੱਕ ਕਿ ਬਾਹਰਲੇ ਦੇਸ਼ਾਂ ਵਿੱਚ ਵੀ ਫੁਲਕਾਰੀ ਨੂੰ ਬਹੁਤ ਹੀ ਜ਼ਿਆਦਾ ਮੰਨਿਆ ਜਾਂਦਾ ਚੰਗਾ ਮੰਨਿਆ ਜਾਂਦਾ ਹਨ ਅਤੇ ਲੋਕ ਕਢਾਈਆਂ ਨੂੰ ਬਹੁਤ ਪਸੰਦ ਕਰਦੇ ਹਨ ਫੁਲਕਾਰੀ ਦੀ ਕਢਾਈਆਂ ਦੇ ਸੂਟ ਫੁਲਕਾਰੀ ਦੇ ਸੂਟ ਬਣਦੇ ਹਨ ਫੁਲਕਾਰੀ ਦੀਆਂ ਚੁੰਨੀਆਂ ਆਉਂਦੀਆਂ ਹਨ ਫੁਲਕਾਰੀ ਦੀਆਂ ਸ਼ੋਲਾਂ ਤੱਕ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਲੋਕੀ ਪਾਉਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਉਹ ਇਹੋ ਜਿਹੀ ਰੰਗ ਬਿਰੰਗੀ ਕਢਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੋਕ ਚੰਗਾ ਵੀ ਪਸੰਦ ਕਰਦੇ ਹਨ ਅਤੇ ਲੋਕ ਵਿਆਹਾਂ 'ਤੇ ਸ਼ਾਦੀਆਂ ਦੇ ਉੱਤੇ ਜਾਗੋ ਵੇਲੇ ਅਤੇ ਬਹੁਤ ਸਾਰੇ ਲੋਕ ਇਹੋ ਜਿਹੀਆਂ ਫੁਲ ਪੰਜਾਬ ਦੀਆਂ ਕਲਾ ਦੀਆਂ ਵਿੱਚ ਜਿੱਦਾਂ ਫੁਲਕਾਰੀ ਹੈ ਹੋਰ ਸਾਰੇ ਬਹੁਤ ਸਾਰੀਆਂ ਕਢਾਈਆਂ ਨੂੰ ਮਾਨਤਾ ਦਿੰਦੇ ਹਨ ਅਤੇ ਉਹੋ ਜਿਹਾ ਪਾ ਕੇ ਆਪਣੇ ਵਿਆਹਾਂ ਵਿੱਚ ਪਾ ਕੇ ਆਪਣਾ ਹੋਰ ਹੀ ਸ਼ਿੰਗਾਰ ਨੂੰ ਚਾਰ ਚੰਦ ਲਗਾ ਦਿੰਦੀਆਂ ਹਨ ਫੁਲਕਾਰੀ ਕਢਾਈ ਇਹੋ ਜਿਹੀ ਵੀ ਕਢਾਈ ਹਨ ਜਿਹੜੀਆਂ ਸ਼ੋਲ 'ਤੇ ਵੀ ਹੁੰਦੀ ਹੈ ਸਰਦੀਆਂ ਦੇ ਵਿੱਚ ਜੇ ਅਸੀਂ ਸ਼ੋਲਾਂ ਲੈਂਦੇ ਹਨ ਤਾਂ ਉਹ ਵੀ ਫੁਲਕਾਰੀ ਕਢਾਈਆਂ ਦੇ ਕੱਢੇ ਹਨ ਗਰਮੀਆਂ ਦੇ ਵਿੱਚ ਫੁਲਕਾਰੀਆਂ ਦੇ ਸੂਟ ਆਉਂਦੇ ਹਨ ਜਿਹੜੇ ਅਸੀਂ ਪਾਉਂਦੇ ਹਾਂ ਅਤੇ ਜਿਹੜੇ ਸੂਟਾਂ ਵਗੈਰਾ ਨੂੰ ਪਾ ਕੇ ਅਸੀਂ ਬਹੁਤ ਹੀ ਜ਼ਿਆਦਾ ਚੰਗਾ ਕੋਟਨ ਦੇ ਕੱਪੜੇ ਦੇ ਉੱਤੇ ਸੂਟ ਵਗੈਰਾ ਸੂਤੀ ਕੱਪੜੇ ਦੇ ਉੱਤੇ ਪਾਉਣਾ ਅਤੇ ਕਢਾਈਆਂ ਕੱਢਣੀਆਂ ਬਹੁਤ ਹੀ ਚੰਗੀ ਲੱਗੀ ਕੱਢਦੇ ਹਨ ਅਤੇ ਲੋ ਜਨਾਨੀਆਂ ਜਿਨਾਂ ਨੂੰ ਇੱਕ ਰੁਜ਼ਗਾਰ ਵੀ ਮਿਲ ਜਾਂਦਾ ਹੈ ਜਿਨ੍ਹਾਂ ਦੇ ਨਾਲ ਸਾਡੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੇ ਜਨਾਨੀਆਂ ਘਰ ਬੈਠੇ ਫੁਲਕਾਰੀ ਦੇ ਉੱਤੇ ਕਢਾਈਆਂ ਦੇ ਸੂਟ ਘਰ ਬੈਠੇ ਬਣਾਉਂਦੀਆਂ ਹਨ ਉਹਨਾਂ ਨੂੰ ਇੱਕ ਤਰ੍ਹਾਂ ਦਾ ਪੈਸੇ ਕਮਾਉਣ ਦਾ ਇੱਕ ਬਹੁਤ ਵੱਡਾ ਇਹ ਸਾਧਨ ਮਿਲ ਜਾਂਦਾ ਹੈ